ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਦਿਵਾ ਹੈ ਮੇਰਾ ਔਡਰ ਨੰਬਰ ਪੰਦਰਾਂ ਛਿਆਹਠ ਹੈ ਤੁਸੀਂ ਯੂ ਕੇ ਫਾਸਟ ਫੂਡ ਤੋਂ ਗੱਲ ਕਰ ਰਹੇ ਹੋ ਮੈਂ ਤੁਹਾਡੇ ਇੱਥੇ ਔਡਰ ਕੀਤਾ ਸੀ ਜੋ ਹੁਣ ਤੱਕ ਨਹੀਂ ਪਹੁੰਚਿਆ ਮੈਨੂੰ ਇਹ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਤੁਹਾਡੇ ਬਾਰੇ ਲੋਕ ਬਹੁਤ ਗੱਲਾਂ ਕਰ ਰਹੇ ਹਨ ਪਰ ਤੁਸੀਂ ਪਹਿਲਾਂ ਵਾਲ਼ਾ ਔਡਰ ਸਮੇਂ ਸਿਰ ਪਹੁੰਚਾਤਾ ਸੀ ਹੁਣ ਤੱਕ ਮੇਰਾ ਔਡਰ ਨਹੀਂ ਆਇਆ ਕਿਰਪਾ ਕਰਕੇ ਇਹ ਔਡਰ ਨੂੰ ਵੀ ਜਲਦੀ ਤੋਂ ਜਲਦੀ ਨਹੀਂ ਮੈਂ ਤੁਹਾਡੀ ਐਪ 'ਤੇ ਕੰਪਲੇਂਟ ਪਾ ਦਊਂਗੀ ਕਿਰਪਾ ਕਰਕੇ ਜਲਦੀ ਤੋਂ ਜਲਦੀ ਮੇਰੀ ਸਮੱਸਿਆ ਦਾ ਹੱਲ ਕਰੋ